ਹੈਲੋ ਸਤਿ ਸ਼੍ਰੀ ਅਕਾਲ ਭਾਈ ਬਾ ਫਲਿਪ ਤੁਸੀਂ ਫਲਿਪਕਾਰਟ ਤੋਂ ਬੋਲਦੇ ਹੋ ਮੈਂ ਤੁਹਾਡੇ ਹੈਵਲਸ ਕੰਪਨੀ ਦੇ ਵਿੱਚੋਂ ਗੀਜ਼ਰ ਦਾ ਆਰਡਰ ਕੀਤਾ ਸੀਗਾ ਅਤੇ ਆਰਡਰ ਤਾਂ ਸਾਡੇ ਕੋਲ ਪਹੁੰਚ ਗਿਆ ਹੈਗਾ ਵਾ ਟਾਈਮ ਸਿਰ ਪਰ ਜਦੋਂ ਆਰਡਰ ਦੇ ਆਰਡਰ ਦੀ ਕੰਡੀਸ਼ਨ ਨਹੀਂ ਸਹੀ ਸੀ ਬੋਕਸ ਪੂਰਾ ਮਤਲਬ ਡੈਮੇਜ ਹੋਇਆ ਪਿਆ ਸੀ ਪਾਣੀ ਦੇ ਨਾਲ ਅਤੇ ਜਦੋਂ ਮੈਂ ਖੋਲ੍ਹ ਕੇ ਦੇਖਿਆ ਤਾਂ ਅੰਦਰ ਗੀਜ਼ਰ ਦੀ ਵੀ ਸਮਾਨ ਕੋਈ ਸਹੀ ਤਰੀਕੇ ਨਾਲ ਰੱਖਿਆ ਨਹੀਂ ਹੋਇਆ ਸੀਗਾ ਕਿਸੇ ਨੇ ਅਤੇ ਜਦੋਂ ਮੈਂ ਉਹਨੂੰ ਗੀਜਰ ਦੀ ਫਿਟਿੰਗ ਕਰਵਾਈ ਤਾਂ ਇਲੈਕਟ੍ਰੀਸ਼ਨ ਤੋਂ ਕਰਵਾਇਆ ਜਿਸ ਦਿਨ ਅਸੀਂ ਪਹਿਲੇ ਦਿਨ ਅਸੀਂ ਚਲਾਇਆ ਤਾਂ ਉਹਦੇ ਵਿੱਚ ਉਹ ਕਰੰਟ ਮਾਰਨ ਲੱਗ ਗਿਆ ਅਤੇ ਉਹ ਪਾਣੀ ਵੀ ਨਹੀਂ ਗਰਮ ਕਰਦਾ ਸੀ ਜਿਸ ਨਾਲ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਪਈ ਹੈ ਇਸ ਪ੍ਰਾਈਮ ਜੇ ਤੁਸੀਂ ਰਿਫੰਡ ਕਰ ਸਕਦੇ ਹੋ ਗੀਜ਼ਰ ਰਿਫੰਡ ਕਰ ਦਿਉ ਪੈਸੇ ਸਾਡੇ ਨਹੀਂ ਤਾਂ ਤੁਸੀਂ ਰਿਪਲੇਸ ਕਰਵਾ ਦਿਉ ਤਾਂ ਕਿ ਜੇ ਤੁਸੀਂ ਰਿਪਲੇਸ ਕਰਵਾਉਂਦੇ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਨਹੀਂ ਤਾਂ ਰਿਫੰਡ ਕਰਵਾਓ ਤਾਂ ਕਿ ਮੈਂ ਦੂਸਰੀ ਵੈਬਸਾਈਟ ਤੋਂ ਨਵਾਂ ਗੀਜ਼ਰ ਆਰਡਰ ਕਰ ਸਕਾਂ ਕਿਉਂਕਿ ਸਾਨੂੰ ਬਹੁਤ ਮੁਸ਼ਕਲ ਆਉਂਦੀ ਪਈ ਹੈਗੀ ਆ ਪਲੀਜ਼ ਸਾਡੀ ਇਹ ਰਿਕੁਐਸਟ ਸਾਡੀ ਅਸੈਪਟ ਕਰ ਲਓ ਅਤੇ ਸਾਨੂੰ ਨਵਾਂ ਗੀਜਰ ਨੇ ਜੇ ਪ੍ਰੋਵਾਈਡ ਕਰ ਦਿਉ